ਹਾਂਜੀ ਤੁਸੀਂ ਹਾਂਜੀ ਕਿੱਥੋਂ ਬੋਲਦੇ ਹੋ ਤੁਸੀਂ ਜੀ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਆਪਾਂ ਨੂੰ ਥੋੜ੍ਹੀ ਬਹੁਤੀ ਤੁਸੀਂ ਫਿਰ ਇਹਦੇ ਬਾਰੇ ਨੌਲੇਜ ਦਿਓਗੇ ਬਈ ਆਪਾਂ ਸੀਸਨਲ ਪਲਾਂਟ ਆਪਾਂ ਲਾਉਣੇ ਆ ਤਾਂ ਬੈ ਕਿਹੜੇ ਕਿਹੜੇ ਲਾਈਦੇ ਹੁੰਦੇ ਆ ਹਾਂਜੀ

ਹਾਂਜੀ

ਤੇ ਪੇੜ ਕਿਹੜੇ ਕਿਹੜੇ ਲਾ ਸਕਦੇ ਆਪਾਂ ਪੇੜ ਠੀਕ ਹੈ ਆਹ ਬੋਹੜ ਹੋ ਗਿਆ ਪਿੱਪਲ ਹੋ ਗਿਆ ਇਹ ਜਾਮਣ ਇਹ ਆਪਾਂ ਕਿਹੜੇ ਮੌਸਮ 'ਚ ਲਾ ਸਕਦੇ ਹਾਂ ਠੀਕ ਆ ਵਾਤਾਵਰਨ ਸ਼ੁੱਧ ਹੁੰਦਾ ਨਾ ਫਿਰ ਪੇੜ ਵੀ ਲਾਉਣੇ ਜ਼ਰੂਰੀ ਹੈ ਹਾਂ ਹਾਂ ਸੀਸਨਲ ਹੋਗੇ ਹਾਂ ਸੀਸਨਲ ਹੋਗੇ ਹਾਂ ਬਿਲਕੁਲ ਹਾਂ ਤਾਂ ਹੁਣ ਸਰ੍ਹੋਂ ਅੱਜ ਕੱਲ੍ਹ ਸਰ੍ਹੋਂ ਅਤੇ ਸਰ੍ਹੋਂ ਹੋ ਗਏ ਹੈ ਨਾ ਇਹ ਨਹੀਂ ਆਪਾਂ ਲਾ ਸਕਦੇ ਸਰ੍ਹੋਂ ਦਾ ਮ ਰੁੱਤ ਚੱਲਦੀ ਪਈ ਆ ਹੁਣ ਆਲੂ ਦੀ ਖੇਤੀ ਫਿਰ ਕਦੋਂ ਕਰੀ ਦੀ ਆ ਆਲੂ ਠੀਕ ਚਲੋ ਹੋਰ ਹਾਂ ਹਾਂਜੀ ਅਤੇ ਚਲੋ ਠੀਕ ਹੈ ਫਿਰ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ